ਸਤਿ ਸ਼੍ਰੀ ਅਕਾਲ ਜੀ ਮੈਂ ਖਾਣੇ ਦਾ ਇੱਕ ਓਡਰ ਕੀਤਾ ਸੀ ਇੱਕ ਘੰਟਾ ਪਹਿਲਾਂ ਮੇਰੇ ਘਰ ਆਏ ਹੋਏ ਸੀ ਮਹਿਮਾਨ ਅਤੇ ਉਨ੍ਹਾਂ ਨੂੰ ਬਿਨਾਂ ਖਾਣਾ ਖਾਏ ਜਾਣਾ ਪਿਆ ਕਿਉਂਕਿ ਖਾਣਾ ਸਮੇਂ ਸਿਰ ਪਹੁੰਚਿਆ ਹੀ ਨਹੀਂ ਉਨ੍ਹਾਂ ਦੀ ਫਲਾਇਟ ਲੇਟ ਹੋ ਜਾਣੀ ਸੀ ਇਸ ਕਰਕੇ ਉਹ ਚਲੇ ਗਏ ਅਤੇ ਮੇਰੀ ਬਹੁਤ ਇਨਸਲਟ ਹੋਈ ਮੈਨੂੰ ਬਹੁਤ ਸ਼ਰਮ ਆਈ ਪਰ ਮੈਂ ਮਜਬੂਰ ਸੀ ਅਤੇ ਇਹ ਬਹੁਤ ਵੱਡੀ ਗਲਤੀ ਹੈ ਤੁਹਾਡੀ ਕੰਪਨੀ ਦੀ ਤਾਂ ਅੱਗੇ ਤੋਂ ਇਸ ਤਰ੍ਹਾਂ ਦੁਹਰਾਇਆ ਨਾ ਜਾਵੇ ਟਾਇਮ ਨਾਲ ਖਾਣਾ ਭੇਜਿਆ ਜਾਵੇ ਡਿਲੀਵਰੀ ਸਮੇਂ ਸਿਰ ਕੀਤੀ ਜਾਵੇ ਤਾਂ ਕਿ ਮੈਨੂੰ ਇਸ ਤਰ੍ਹਾਂ ਦੀ ਨਾਮੋਸ਼ੀ ਦਾ ਸਾਹਮਣਾ ਨਾ ਕਰਨਾ ਪਵੇ ਅੱਜ ਲਈ ਮੈਂ ਬਹੁਤ ਡਿਪਰੈੱਸਡ ਹੋਈ ਅੱਗੋਂ ਤੋਂ ਧਿਆਨ ਰੱਖਣਾ ਜੀ ਧੰਨਵਾਦ